ਪੰਜਾਬ ਵਿੱਚ ਕੀ ਸਿਹਤ ਸੰਭਾਲ ਵਾਸਤੇ ਅੱਜ ਕੱਲ੍ਹ ਮੁਹੱਲੇ ਮੁਹੱਲੇ ਵਿੱਚ ਕਲੀਨਿਕਾਂ ਖੋਲ੍ਹੀਆਂ ਜਾਂਦੀਆਂ ਨੇ ਜੋ ਕਿ ਸਰਕਾਰੀ ਹੌਸਪਿਟਲ 'ਚ ਵੀ ਬਹੁਤ ਵਧੀਆ ਕੇਅਰ ਹੈ ਕਿ ਟੈਮ ਟੈਮ ਸਿਰ ਵਧੀਆ ਤੋਂ ਵਧੀਆ ਦਵਾਈਆਂ ਦਿੱਤੀਆਂ ਜਾਂਦੀਆਂ ਹਨ ਕਿਉਂਕਿ ਅੱਗੇ ਕੀ ਜੋ ਰਾਤ ਨੂੰ ਜਦੋਂ ਵੀ ਕੋਈ ਬਿਮਾਰ ਹੁੰਦਾ ਸੀ ਪੇਸ਼ੈਂਟ ਛੇਤੀ ਛੇਤੀ ਨੇੜੇ ਤੇੜੇ ਕੋਈ ਡਾਕਟਰ ਹੋਸਪਿਟਲ 'ਚ ਨਹੀਂ ਸੀ ਮਿਲਦਾ ਹੁਣ ਕੀ ਜ ਥਾਂ ਹਰ ਮੁਹੱਲੇ ਵਿੱਚ ਇੱਕ ਛੋਟਾ ਜਿਹਾ ਕਲੀਨਿਕ ਹੁੰਦਾ ਹੈ ਲੋੜ ਪੈਣ 'ਤੇ ਕਿ ਅਸੀਂ ਕਲੀਨਿਕ ਤੋਂ ਦਵਾਈ ਲਿਆ ਸਕਦੇ ਹਾਂ ਜੋ ਕਿ ਅੱਗੇ ਬਿਮਾਰੀ ਨਾਲ ਜੂਝ ਰਹੇ ਪੇਸ਼ੈਂਟ ਕਿਸੇ ਨੂੰ ਵੀ ਟਾਈਮ 'ਤੇ ਦਵਾਈ ਨਹੀਂ ਹੁਣ ਜੋ ਕਿ ਕਾਰਡ ਬਣਾਏ ਨੇ ਜੋ ਕਾਰਡ ਨੇ ਕਾਰਡਾਂ 'ਤੇ ਵਧੀਆ ਵੀ ਚੰਗੀ ਤਰ੍ਹਾਂ ਇਲਾਜ ਹੁੰਦਾ ਵਧੀਆ ਸਿਹਤ ਸੰਭਾਲ ਲਈ ਦਵਾਈਆਂ ਮਿਲਦੀਆਂ ਨੇਗੀਆਂ ਹਰ ਜ਼ਰੂਰਤ ਪੈਣ 'ਤੇ ਹਰੇਕ ਤਰ੍ਹਾਂ ਦਾ ਹਰੇਕ ਕਿਸਮ ਦੀ ਦਵਾਈ ਸਰਕਾਰੀ ਹਸਪਤਾਲਾਂ ਦੇ ਵਿੱਚ ਵਧੀਆ ਕੇਅਰਾਂ ਹੈ ਵਧੀਆ ਵਧੀਆ ਡਾਕਟਰ ਨੇ ਟਾਇਮ ਟਾਇਮ ਸਿਰ ਹਰ ਇੱਕ ਚੀਜ਼ ਦੇ ਜਿਹੜੀ ਜ਼ਰੂਰਤ ਪੈਣ 'ਤੇ ਨਰਸਾਂ ਹੈ ਜਾਂ ਜੋ ਹੁੰਦੀਆਂ ਲੋੜ ਪੈਂਦੀ ਹੈ ਦਵਾਈ ਸਾਨੂੰ ਟਾਈਮ ਟਾਈਮ ਸਿਰ ਵਧੀਆ ਮਿਲਦੀ ਹੈ ਹਰੇਕ ਜਗ੍ਹਾ 'ਤੇ ਵਧੀਆ ਇਲਾਜ ਟਾਇਮ ਟਾਇਮ ਸਿਰ ਇਲਾਜ ਮਿਲ ਜਾਂਦਾ ਜੋ ਕਿ ਜ਼ਰੂਰਤ ਬਹੁਤ ਹੁੰਦੀ ਹੈ ਹਰੇਕ ਸਾ ਮੁਹੱਲੇ 'ਚ ਹੌਸਪਿਟਲ ਦੇ ਵਿੱਚ ਸਾਰਾ ਹੀ ਸਾਨੂੰ ਇੰਤਜ਼ਾਮ ਅਤੇ ਸੇਵਾਵਾਂ ਮਿਲਦੀਆਂ ਹਨ ਇਸ ਕਾਰਨ ਬਹੁਤ ਹੀ ਵਧੀਆ ਵੀ ਇਲਾਜ ਹੁਣ ਮਿਲਦਾ ਸਿਹਤ ਵਾਸਤੇ ਚੰਗੀਆਂ ਦਵਾਈਆਂ ਚੰਗਾ ਸਾਰਾ ਕੁਝ ਸਾਨੂੰ ਵੀ ਮਿਲਦਾ ਮੁਹੱਲੇ ਵਿੱਚ ਵੀ ਸਰਕਾਰੀ ਹੌਸਪਿਟਲ ਵਿੱਚ ਵੀ ਡਾਕਟਰ ਹਰੇਕ ਤਰ੍ਹਾਂ ਦੇ ਹਰੇਕ ਕਿਸਮ ਦੇ ਡੋਕਟਰ ਨੇ ਜੋ ਕਿ ਹਰ ਪੇਸ਼ੈਂਟ ਨੂੰ ਬਹੁਤ ਵਧੀਆ ਟੈਂਡ ਕਰਦੇ ਨੇ ਅਤੇ ਰਾਤ ਨੂੰ ਸੁਬਹ ਸ਼ਾਮ ਸਵੇਰੇ ਜਿਸ ਵਕਤ ਵੀ ਅਸੀਂ ਜਾਂਦੇ ਹਾਂ ਸਾਨੂੰ ਦਵਾਈਆਂ ਹੀ ਮਿਲਦੀਆਂ ਇਸ ਕਾਰਨ ਅਸੀਂ ਹੌਸਪਿਟਲ ਜਾਂਦੇ ਹਾਂ ਅਤੇ ਦਵਾਈ ਨੂੰ ਲੈ ਕੇ ਅਸੀਂ ਘਰ ਜਦੋਂ ਆਉਂਦੇ ਹਾਂ ਸਾਨੂੰ ਬੜੀ ਖੁਸ਼ੀ ਮਿਲਦੀ ਹੈ